ਆਪਣੇ ਬਗੀਚੇ ਦੇ ਵਿੱਚ ਮੈਂ ਵਾਤਾਵਰਨ ਅਤੇ ਜੰਗਲੀ ਜੀਵਾਂ ਦੀਆਂ ਲੋੜਾਂ ਦੇ ਦੀ ਗੱਲ ਕਰੀਏ ਤਾਂ ਇੱਕ ਤਾਂ ਅਸੀਂ ਜਿਹੜੀ ਰੂੜੀ ਵਾਲੀ ਖਾਦ ਆ ਜਿਹੜੀ ਗੋਬਰ ਤੋਂ ਬਣਦੀ ਹੈ ਮੱਝਾਂ ਗਾਵਾਂ ਦੇ ਗੋਬਰ ਤੋਂ ਬਣਦੀ ਆ ਉਹਦੀ ਵਰਤੋਂ ਕਰਦੇ ਆ ਜੀ ਦੂਜਾ ਅਸੀਂ ਗੰਡੋਇਆਂ ਦੀ ਖਾਦ ਪਾਉਦੇ ਆਂ ਜਿਹਦੇ ਨਾਲ ਸਾਡੇ ਪੌਦਿਆਂ ਨੂੰ ਸੰਤੁਲਿਤ ਭੋਜਨ ਮਿਲਦਾ ਖਾਦ ਆ ਜਿਹੜੀ ਉਹ ਉਹਨਾਂ ਦੀ ਜਿਹੜੀ ਵ ਵੱਧਣ ਫੁੱਲਣ ਦੇ ਵਿੱਚ ਮਦਦ ਕਰਦੀ ਹੈ ਅਤੇ ਗੰਡੋਏ ਦੀ ਖਾਦ ਆ ਜਿਹੜੀ ਬੜੀ ਉਹ ਮੰਨੀ ਜਾਂਦੀ ਆ ਜਾਂ ਫਿਰ ਮੁਰਗੀ ਫਾਰਮ ਮੁਰਗੀਆਂ ਦੀ ਜਿਹੜੀ ਖਾਦ ਆ ਉਹ ਵੀ ਬੜੀ ਤਾਕਤਵਰ ਹੁੰਦੀ ਆ ਜਿਹਨੂੰ ਅਸੀਂ ਆਪਦੇ ਪੌਦਿਆਂ ਦੀਆਂ ਜੜ੍ਹਾਂ 'ਚ ਪਾਉਂਦੇ ਹਾਂ ਖਾਦ ਦੀ ਵਰਤੋਂ ਦੇ ਤੌਰ 'ਤੇ ਅਤੇ ਵਾਤਾਵਰਨ ਦੇ ਵਿੱਚ ਸਾਡੀ ਇਹ ਜਿਹੜੀ ਜੇ ਦੂਜਾ ਅਸੀਂ ਕੀਟਮਾਰ ਜਿਹੜੀਆਂ ਦਵਾਈਆਂ ਨੇ ਉਹਨਾਂ ਦੀ ਵਰਤੋਂ ਨਹੀਂ ਕਰਦੇ ਆ ਜਿਹੜੇ ਦੂਜੇ ਕੈਮੀਕਲਾਂ ਦੇ ਰੇਅ ਨੇ ਉਹਨਾਂ ਦੀ ਵਰਤੋਂ ਨਹੀਂ ਕਰਦੇ ਹੈਗੇ ਖਾਦ ਜਿਹੜੇ ਨੇ ਉਹਨਾਂ ਦੀ ਵਰਤੋਂ ਨਾ ਕਰਕੇ ਅਸੀਂ ਜਿਹੜੀਆਂ ਆਮ ਖਾਦਾਂ ਨੇ ਜਿਹੜੀਆਂ ਜ ਜੰਗਲੀ ਜੀਵਾਂ ਦੀਆਂ ਬੇਕਾਰ ਬਿੱਠਾਂ ਤੋਂ ਜਾਂ ਜਿਹੜੀ ਖਾਦ ਬਣਦੀ ਆ ਗੋਬਰ ਤੋਂ ਉਹਦੀ ਵਰਤੋਂ ਕਰਕੇ ਅਸੀਂ ਆਪਣੀਆਂ ਲੋੜਾਂ ਪੂਰਾ ਕਰਦੇ ਹਾਂ